ਸਕੂਲ ਵਿੱਚ ਸਾਡਾ ਮਨਪਸੰਦ ਵਿਸ਼ਾ ਪੰਜਾਬੀ ਸੀ ਇਹ ਸਾਡੀ ਮਾਤ ਭਾਸ਼ਾ ਵੀ ਹੈ ਅਤੇ ਇਸ ਵਿੱਚ ਸਾਰੇ ਦਸੇ ਗੁਰੂਆਂ ਦੇ ਜੋ ਵੀ ਭਾਰਤ ਵਿੱਚ ਲੜਾਈਆਂ ਹੋਈਆਂ ਜੋ ਵੀ ਹੋਇਆ ਉਸਦਾ ਸਾਰਾ ਇਸ ਵਿੱਚ ਵਰਨਣ ਹੈ ਦਸੇ ਗੁਰੂਆਂ ਦਾ ਸਾਰਾ ਇਸ ਵਿੱਚ ਵਰਨਣ ਹੈ ਅਤੇ ਇਹ ਇਹ ਭਾਸ਼ਾ ਸੌਖੀ ਵੀ ਬਹੁਤ ਹੈ ਬੋਲਣ ਲਈ ਅਤੇ ਇਸ ਭਾਸ਼ਾ ਨੂੰ ਸਾਰੇ ਪੰਜਾਬੀ ਸਾਡੇ ਪਿਆਰ ਕਰਦੇ ਆ